ਕੀ ਯੋਗਾ ਸਿਰਫ ਕਸਰਤ ਦਾ ਇੱਕ ਰੂਪ ਹੈ ਜਾਂ ਕੁਝ ਹੋਰ ਅਸਲ ਦੇ ਵਿੱਚ ਯੋਗ ਨੂੰ ਜੇਕਰ ਆਪਾਂ ਕਸਰਤ ਦੇ ਰੂਪ ਵਿੱਚ ਕਹੀਏ ਤਾਂ ਇਹ ਇਸ ਲਈ ਬਹੁਤ ਛੋਟੀ ਗੱਲ ਹੈ ਯੋਗ ਦਾ ਮਤਲਬ ਹੁੰਦਾ ਹੈ ਜੋੜਨਾ ਸਭ ਤੋਂ ਪਹਿਲਾਂ ਯੋਗ ਆਪਾਂ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦੀ ਇੱਕ ਪ੍ਰਕਿਰਿਆ ਹੈ ਯੋਗ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਆਸਣ ਅਤੇ ਵੱਖ ਵੱਖ ਤਰੀਕੇ ਦੇ ਮੈਡੀਟੇਸ਼ਨ ਹੁੰਦੇ ਹਨ ਯੋਗ ਰਾਹੀਂ ਅਸੀਂ ਇੱਕ ਇਨਸਾਨ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਸਕਦਾ ਹੈ ਜਿਸ ਨੂੰ ਆਪਾਂ ਪਰਮ ਸਮਾਧੀ ਹੀ ਕਹਿੰਦੇ ਹਾਂ ਕਈ ਲੋਕ ਯੋਗ ਨੂੰ ਸਿਰਫ ਫਿਟ ਰਹਿਣ ਲਈ ਤੰਦਰੁਸਤ ਰਹਿਣ ਲਈ ਇੱਕ ਕਸਰਤ ਦੇ ਵਾਂਗ ਹੀ ਕਰਦੇ ਹਨ ਪਰ ਦੇਖਿਆ ਜਾਵੇ ਯੋਗ ਇੱਕ ਪ੍ਰਕਿਰਿਆ ਹੈ ਜਿਸ ਨਾਲ ਮਨੁੱਖ ਭਗਵਾਨ ਹੋ ਜਾਂਦਾ ਹੈ ਯੋਗ ਰਾਹੀਂ ਅਸੀਂ ਸਮਾਧੀ ਦੇ ਵਿੱਚ ਬੈਠ ਕੇ ਕਾਫੀ ਸਮਾਂ ਸਾਡੇ ਯੋਗ ਕਰਨ ਨਾਲ ਚੱਕਰ ਜਾਗਰੂਕਤ ਹੋ ਜਾਂਦੇ ਹਨ ਜਿਸ ਨੂੰ ਕੁੰਡਲੀਨੀ ਜਾਗਰਣ ਕਹਿੰਦੇ ਹਨ ਕੁੰਡਲੀਨੀ ਜਾਗਰਣ ਹੁੰਦੀ ਹੈ ਉਸ ਤੋਂ ਬਾਅਦ ਇਨਸਾਨ ਦੇ ਸੱਤ ਚੱਕਰ ਐਕਟਿਵ ਹੁੰਦੇ ਹਨ ਅਤੇ ਮਨੁੱਖ ਸਮਾਧੀ ਦੇ ਵਿੱਚ ਚਲਾ ਜਾਂਦਾ ਹੈ ਫਿਰ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਸਾਡੇ ਜਿੰਨੇ ਵੀ ਮਹਾਂਪੁਰਸ਼ ਅਵਤਾਰ ਇਸ ਧਰਤੀ ਦੇ ਉੱਪਰ ਆਏ ਸਭ ਨੇ ਯੋਗ ਕੀਤਾ ਜਿੰਨੇ ਨਾਥ ਸਾਧੂ ਸੰਤ ਮਹਾਤਮਾ ਆਏ ਸਭ ਨੇ ਯੋਗ ਰਾਹੀਂ ਹੀ ਪਰਮਾਤਮਾ ਨੂੰ ਪਾਇਆ ਅਤੇ ਭਟਕੇ ਭੁੱਲੇ ਭਟਕੇ ਮਨੁੱਖਾਂ ਨੂੰ ਚੰਗੇ ਰਸਤੇ 'ਤੇ ਅਧਿਆਤਮ ਦੇ ਰਸਤੇ 'ਤੇ ਜੋੜਿਆ ਪਰ ਅਜੋਕੀ ਦੁਨੀਆਂ ਦੇ ਵਿੱਚ ਇਹ ਕਈ ਪ੍ਰਕਿਰਿਆਵਾਂ ਖਤਮ ਹੋਣ ਦੀ ਕਗਾਰ 'ਤੇ ਹਨ ਅਤੇ ਯੋਗ ਵੀ ਸਿਰਫ ਤੰਦਰੁਸਤ ਰਹਿਣ ਲਈ ਹੀ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੁਛ ਕੁ ਸਰੀਰਕ ਆਸਣ ਅਸੀਂ ਕਰਦੇ ਹਾਂ ਪ੍ਰਾਣਯਾਮ ਵਗੈਰਾ ਵੀ ਅੱਜ ਕੱਲ੍ਹ ਲੋਕ ਫਿਟ ਰਹਿਣ ਲਈ ਹੀ ਕਰ ਰਹੇ ਹਨ ਅਸਲ ਦੇ ਵਿੱਚ ਪ੍ਰਾਣਯਾਮ ਵੀ ਇੱਕ ਪਰਮਾਤਮਾ ਨੂੰ ਮਿਲਣ ਦੀ ਪ੍ਰਕਿਰਿਆ ਹੈ ਸਾਨੂੰ ਸਭ ਨੂੰ ਯੋਗ ਬਾਰੇ ਜਾਣਨ ਲਈ ਯੋਗ ਦੀਆਂ ਵੱਖ ਵੱਖ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਹਰ ਮਨੁੱਖਾਂ ਨੂੰ ਯੋਗ ਕਰਨਾ ਚਾਹੀਦਾ ਹੈ